ਅਠਾਰਾਂ ਅਗਸਤ ਉੱਨੀ ਸੌ ਸੱਠ ਇੱਕੀ ਦਿਸੰਬਰ ਦੋ ਹਜ਼ਾਰ ਇੱਕੀ ਪੰਦਰਾਂ ਮਾਰਚ ਉੱਨੀ ਸੌ ਇਕਹੱਤਰ ਵੀਹ ਸਤੰਬਰ ਦੋ ਹਜ਼ਾਰ ਚਾਰ ਤੇਰਾਂ ਦਿਸੰਬਰ ਦੋ ਹਜ਼ਾਰ ਇੱਕ